ਥੋੜੇ ਦਿਨਾਂ ਪਹਿਲਾਂ ਮੈਂ ਆਪਣੇ ਮਾਮੇ ਦੇ ਦਾਦੇ ਦੇ ਅੰਤਿਮ ਸੰਸਕਾਰ ਚ ਗਈ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਸੀ ਉਹ ਪਿੰਡ ਵਿੱਚ ਸੀ ਅਤੇ ਉੱਥੇ ਦੇ ਲੋਕਾਂ ਨੂੰ ਇਨਾ ਇੰਨੀ ਜਾਣਕਾਰੀ ਵੀ ਨਹੀਂ ਸੀ ਕਿ ਇਸ ਚੀਜ਼ ਬਾਰੇ ਕਾਰਪੋਰੇਸ਼ਨ ਚ ਜਾ ਕੇ ਦੱਸਣਾ ਚਾਹੀਦਾ ਤੇ ਉਹਨਾਂ ਦਾ ਮੌਤ ਸਰਟੀਫਿਕੇਟ ਵੀ ਬਣਵਾਣਾ ਚਾਹੀਦਾ ਤੇ ਉੱਥੇ ਜਾ ਕੇ ਮੈਂ ਕੋਈ ਦੇਖਿਆ ਕੀ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਸੀ ਤੇ ਮੈਂ ਉਹਨਾਂ ਚੋ ਦੇਖਿਆ ਕੀ ਇੱਕ ਹੀ ਇਨਸਾਨ ਸੀ ਜਿਹੜਾ ਪੜਿਆ ਲਿਖਿਆ ਸੀ ਤੇ ਮੈਂ ਉਹਨਾਂ ਨੂੰ ਬੁਲਾਇਆ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਅੰਕਲ ਜੀ ਦਾ ਡੈਥ ਸਰਟੀਫਿਕੇਟ ਬਣਵਾਓ ਜੋ ਕਿ ਬਹੁਤ ਜਰੂਰੀ ਹੈ ਕੋਰਪਰੇਸ਼ਨ 'ਚ ਜਾਓ ਰਜਿਸਟਰ ਕਰਾਓ ਉਹਨਾਂ ਦਾ ਨਾਮ ਕਿ ਕੱਲ ਨੂੰ ਤੁਹਾਨੂੰ ਕੋਈ ਲੈ ਇਸ ਚੀਜ਼ ਨੂੰ ਲੈ ਕੇ ਕੋਈ ਦਿੱਕਤ ਨਾ ਆਏ ਤੇ ਮੈਂ ਉਹਨਾਂ ਲਈ ਦੁੱਖ ਵੀ ਸਾਂਝਾ ਕੀਤਾ ਮੈਨੂੰ ਬਹੁਤ ਬੁਰਾ ਲੱਗਿਆ ਕਿ ਕਿਸੇ ਦੇ ਘਰ ਦਾ ਜੀਅ ਵੀ ਚਲਾ ਗਿਆ